ਇਹ ਦੁਨੀਆਂ ਬਹੁਤ ਵੱਡੀ ਹੈ ਇਸ ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਸ਼ ਹਨ ਜਿੱਥੋਂ ਦੀਆਂ ਜਿੱਥੋਂ ਦੇ ਮੌਸਮ ਜਿੱਥੋਂ ਦੀਆਂ ਰੁੱਤਾਂ ਜਿੱਥੋਂ ਦੇ ਪਹਾੜ ਜਿੱਥੋਂ ਦੇ ਦਰੱਖਤ ਜਿੱਥੋਂ ਦੇ ਜਗ੍ਹਾ ਜਿੱਥੋਂ ਦਾ ਜਿੱਥੋਂ ਦੀਆਂ ਆਪਣੀਆਂ ਆਪਣੀਆਂ ਖੂਬੀਆਂ ਹਨ ਇਸ ਦੁਨੀਆਂ ਦੇ ਵਿੱਚ ਇਸ ਦੁਨੀਆਂ ਨੂੰ ਬਣਾਉਣ ਵਾਲੇ ਨੇ ਇਸ ਦੁਨੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਣਾਇਆ ਹੈ ਇਸ ਲਈ ਮੈਂ ਘੁੰਮਣਾ ਫਿਰਨਾ ਪਸੰਦ ਕਰਦਾ ਹਾਂ ਤਾਂ ਕਿ ਮੈਂ ਇਸ ਦੁਨੀਆਂ ਦੇ ਵਿੱਚ ਬਣੀ ਹਰ ਇੱਕ ਵੱਖਰੀ ਪਹਿਚਾਣ ਵਾਲੀ ਚੀਜ਼ ਨੂੰ ਦੇਖ ਸਕਾਂ ਅਤੇ ਆਪਣੇ ਉਸ ਚੀਜ਼ ਨੂੰ ਦੇਖ ਕੇ ਆਪਣੇ ਜੀਵਨ ਦੇ ਵਿੱਚ ਕੋਈ ਸਿੱਖਿਆ ਲੈ ਸਕਾਂ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਹਰੇਕ ਹਰ ਇੱਕ ਮੁਸ਼ਕਿਲ ਦਾ ਸਾਹਮਣਾ ਕਰਨ ਲਈ ਤਿਆਰ ਰਹਾਂ ਮੈਨੂੰ ਘੁੰਮਣਾ ਫਿਰਨਾ ਬਹੁਤ ਪਸੰਦ ਹੈ ਅਤੇ ਮੈਂ ਅਕਸਰ ਹੀ ਯਾਤਰਾਵਾਂ 'ਤੇ ਜਾਂਦਾ ਰਹਿੰਦਾ ਹਾਂ ਜਿਵੇਂ ਕਿ ਪਿਛਲੀਆਂ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਮੈਂ ਉੱਤਰਾਖੰਡ ਦਾ ਚੱਕਰ ਲਗਾ ਕੇ ਆਇਆ ਜਿੱਥੇ ਕਿ ਮੈਂ ਅਲਮੋੜਾ ਦੇ ਪਿੰਡ ਲਾਲਪੁਰ ਦੇ ਵਿੱਚ ਗਿਆ ਜਿੱਥੇ ਮੈਂ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਅਤੇ ਉੱਥੋਂ ਦੇ ਲੋਕਾਂ ਦੇ ਕੰਮਕਾਰ ਬਾਰੇ ਜਾਣਕਾਰੀ ਲਈ ਉੱਥੋਂ ਦੇ ਲੋਕ ਜ਼ਿਆਦਾਤਰ ਜ਼ਿਆਦਾਤਰ ਟਰੈਵਲਿੰਗ ਜਾਂ ਫਿਰ ਜ਼ਿਆਦਾਤਰ ਖਾਣੇ ਨੂੰ ਖਾਣੇ ਢਾਬੇ ਵਗੈਰਾ ਨੂੰ ਲੈ ਕੇ ਆਪਣਾ ਰੁਜ਼ਗਾਰ ਕ ਚੱਲ ਕਰਾ ਕਰਦੇ ਹਨ ਕਿਉਂਕਿ ਉੱਥੋਂ ਦਾ ਜੋ ਏਰੀਆ ਹੈ ਉਹ ਇੱਕ ਪਹਾੜੀ ਏਰੀਆ ਹੈ ਜਿਸ ਕਰਕੇ ਉੱਥੋਂ ਦੇ ਲੋਕਾਂ ਕੋਲ ਕੋਈ ਹੋਰ ਕੋਈ ਕੰਮਕਾਰ ਨਹੀਂ ਹੈ ਅਤੇ ਮੈਨੂੰ ਘੁੰਮਣਾ ਫਿਰਨਾ ਇਸ ਲਈ ਵੀ ਪਸੰਦ ਹੈ ਤਾਂ ਕਿ ਮੈਂ ਪੂਰੀ ਦੁਨੀਆਂ ਨੂੰ ਦੇਖ ਸਕਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਇਹ ਸਾਰੀ ਦੁਨੀਆਂ ਨੂੰ ਆਪਣੇ ਅੱਖੀਂ ਦੇਖ ਸਕਾਂ ਜਿਸ ਨੂੰ ਮੈਂ ਆਪਣੇ ਮੋਬਾਇਲ ਦੀ ਸਕਰੀਨ ਦੇ ਉੱਤੇ ਦੇਖ ਰਿਹਾ ਹੁੰਦਾ ਹਾਂ